ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਮੈਂ ਨਾ ਇੱਥੇ ਬਠਿੰਡੇ ਘੁੰਮਣ ਆਈ ਹੋਈ ਹਾਂ ਸੀ ਮੈਨੂੰ ਤੁਹਾਡਾ ਨੰਬਰ ਮਿਲਿਆ ਸੀ ਐਜ ਏ ਗਾਈਡ ਤਾਂ ਮੈਂ ਘੁੰਮਣਾ ਚਾਹੁੰਦੀ ਹਾਂ ਜੀ ਬਠਿੰਡੇ 'ਚ ਤਿੰਨ ਦਿਨ ਰਹਿ ਕੇ ਅਤੇ ਮੈਨੂੰ ਕਿਹੜੀਆਂ ਕਿਹੜੀਆਂ ਜਗ੍ਹਾ 'ਤੇ ਘੁੰਮ ਸਕਦੀ ਹਾਂ ਇੱਕ ਤਾਂ ਇਹ ਦੱਸ ਦਿਓ ਜੀ ਅਤੇ ਇੱਕ ਮਤਲਬ ਕਿ ਸੌਖੇ ਤਰੀਕੇ ਨਾਲ ਕਿਵੇਂ ਰਹਿਣ ਦਾ ਕੀ ਧੰਨਵਾਦ ਮੈਮ ਹਾਂਜੀ ਮੈਮ ਮੈਮ ਕੱਲ੍ਹ ਤੋਂ ਹੀ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਠੀਕ ਹੈ ਜੀ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਠੀਕ ਹੈ ਮੈਮ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਠੀਕ ਹੈ ਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਅਤੇ ਨੇੜੇ ਇੱਥੇ ਕੋਈ ਧਾਰਮਿਕ ਸਥਾਨ ਕਿੱਥੇ ਰਹਿ ਪੈ ਜਾਂਦਾ ਜੀ ਆਪਾਂ ਨੂੰ ਬਠਿੰਡੇ ਦੇ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਮੈਮ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਧੰਨਵਾਦ ਜੀ ਬਹੁਤ ਬਹੁਤ